ਪੰਜਾਬ ਪੰਜਾਬ ਦੇ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਪੰਜ ਆਬ ਪੰਜ ਆਬ ਦਾ ਮਤਲਬ ਹੈ ਪੰਜਾਂ ਦਰਿਆਵਾਂ ਦੀ ਧਰਤੀ ਇੱਥੇ ਪੰਜ ਦਰਿਆ ਹਨ ਜਿਵੇਂ ਕਿ ਰਾਵੀ ਬਿਆਸ ਸਤਲੁਜ ਚਨਾਬ ਅਤੇ ਜੇਹਲਮ ਇਹਨਾਂ ਪੰਜਾਂ ਦਰਿਆਵਾਂ ਵਿੱਚੋਂ ਦੋ ਦਰਿਆ ਪਾਕਿਸਤਾਨ ਵਿੱਚ ਚਲੇ ਗਏ ਹਨ ਇੱਥੇ ਦਾ ਸੱਭਿਆਚਾਰ ਬਹੁਤ ਹੀ ਅਮੀਰ ਹੈ ਇੱਥੇ ਕੁੜੀਆਂ ਕਮੀਜ਼ ਅਤੇ ਸਲਵਾਰ ਪਾਉਦੀਆਂ ਹਨ ਅਤੇ ਸਿਰ ਤੇ ਦੁਪੱਟਾ ਲੈਂਦੀਆਂ ਹਨ ਅਤੇ ਮੁੰਡੇ ਕੁੜਤਾ ਚਾਦਰਾ ਪਾਉਂਦੇ ਹਨ ਗਲੇ ਵਿੱਚ ਕੈਂਠਾ ਪਾਉਂਦੇ ਹਨ ਜਾਂ ਕੁੜਤਾ ਪਜਾਮਾ ਪਾਉਂਦੇ ਹਨ ਇੱਥੇ ਦਾ ਕੁੜੀਆਂ ਦਾ ਡਾਂਸ ਗਿੱਧਾ ਅਤੇ ਬੋਲੀਆਂ ਹਨ ਅਤੇ ਮੁੰਡਿਆਂ ਦਾ ਭੰਗੜਾ ਹੈ ਇਹ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ ਇਹ ਇੱਥੋਂ ਦਾ ਫੋਕ ਡਾਂਸ ਹੈ ਜਦੋਂ ਕੁੜੀਆਂ ਗਿੱਧਾ ਪਾਉਂਦੀਆਂ ਹਨ ਤਾਂ ਪੂਰਾ ਪੂਰਾ ਧਮਾਲਾ ਪੈ ਜਾਂਦੀਆਂ ਹਨ ਇਸ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ